ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਂਕ ਹੈ ਅਲੱਗ ਅਲੱਗ ਚੀਜ਼ਾਂ ਪਕਾਉਣ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਤਿਉਹਾਰਾਂ 'ਤੇ ਵਿਸ਼ੇਸ਼ ਕਰਕੇ ਤਿਉਹਾਰਾਂ 'ਤੇ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੀ ਹਾਂ ਮੈਨੂੰ ਸਭ ਤੋਂ ਪਹਿਲਾਂ ਤਿਉਹਾਰਾਂ 'ਤੇ ਪਕੌੜੇ ਬਣਾਉਣੇ ਪਸੰਦ ਨੇ ਮੈਂ ਪਕੌੜੇ ਹਰ ਤਰ੍ਹਾਂ ਦੇ ਬਣਾਉਂਦੀ ਹਾਂ ਆਲੂ ਵਾਲੇ ਪਿਆਜ਼ ਸ਼ਿਮਲਾ ਮਿਰਚ ਬੈਂਗਣ ਸਭ ਤੋਂ ਵਧੀਆ ਮੈਨੂੰ ਬੈਂਗਣ ਵਾਲੇ ਪਕੜੇ ਬਣਾਉਣੇ ਪਸੰਦ ਹੈ ਗੋਭੀ ਵਾਲੇ ਪਾਲਕ ਵਾਲੇ ਅਤੇ ਇਹ ਪਕੌੜੇ ਜਦੋਂ ਮੈਂ ਬਣਾਦੀ ਹਾਂ ਮੇਰੇ ਘਰ 'ਚ ਸਾਰੇ ਖੁਸ਼ ਹੋ ਕੇ ਖਾਂਦੇ ਨੇ ਅਤੇ ਤਿਉਹਾਰਾਂ 'ਤੇ ਮੈਂ ਕੇਕ ਵੀ ਬਣਾਉਂਦੀ ਹਾਂ ਬਿਸਕਿਟ ਵਾਲਾ ਕੇਕ ਸੂਜੀ ਵਾਲਾ ਕੇਕ ਕਿਉਂਕਿ ਜਿਹੜੇ ਬਾਹਰਲੇ ਕੇਕ ਹੈ ਉਹਨਾਂ 'ਚ ਆਂਡਾ ਹੁੰਦਾ ਫਿਰ ਘਰਦੇ ਨਹੀਂ ਖਾਂਦੇ ਤਾਂ ਇਸ ਕਰਕੇ ਮੈਂ ਤਿਉਹਾਰਾਂ 'ਚ ਇਹ ਵਾਲੇ ਕੇਕ ਬਣਾ ਲੈਂਦੀ ਹਾਂ ਅਤੇ ਇਸ ਤੋਂ ਇਲਾਵਾ ਮੈਨੂੰ ਪਾਲਕ ਵਾਲੀ ਬਰਫੀ ਬਣਾਉਣੀ ਬਹੁਤ ਜ਼ਿਆਦਾ ਪਸੰਦ ਹੈ ਬਹੁਤ ਜ਼ਿਆਦਾ ਸਵਾਦਿਸ਼ਟ ਹੁੰਦੀ ਹੈ ਬਾਹ ਬਾਹਰ ਦੀ ਬਰਫੀ ਨਾਲੋਂ ਬਹੁਤ ਜ਼ਿਆਦਾ ਸਵਾਦਿਸ਼ਟ ਹੁੰਦੀ ਹੈ ਅਤੇ ਮੈਨੂੰ ਇਹ ਅਲੱਗ ਅਲੱਗ ਚੀਜ਼ਾਂ ਬਣਾਉਣੀਆਂ ਬਹੁਤ ਜ਼ਿਆਦਾ ਪਸੰਦ ਹੈ ਇਸ ਤੋਂ ਇਲਾਵਾ ਮੈਂ ਤਿਉਹਾਰਾਂ 'ਚ ਹਲਵਾ ਮੂੰਗੀ ਦਾ ਹਲਵਾ ਜਾਂ ਫਿਰ ਕੋਈ ਹੋਰ ਹਲਵਾ ਉਹ ਬਣਾ ਕੇ ਖਾ ਖਵਾਉਂਦੀ ਹਾਂ ਉਹ ਪਕਾਉਂਦੀ ਹਾਂ ਅਤੇ ਇਸ ਤੋਂ ਇਲਾਵਾ ਮੈਨੂੰ ਜਦੋਂ ਤਿਉਹਾਰ ਹੁੰਦੇ ਜਦੋਂ ਨਰਾਤੇ ਹੁੰਦੇ ਆ ਉਦੋਂ ਫਿਰ ਮੈਨੂੰ ਪੂੜੀਆਂ ਪਕਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਫਿਰ ਮੈਂ ਉਹ ਪੂੜੀਆਂ ਪਕਾਨੀ ਹਾਂ ਅਤੇ ਸਾਰਾ ਕੁਝ ਅਤੇ ਸਾਰੇ ਮੈਨੂੰ ਤਿਉਹਾਰਾਂ 'ਤੇ ਬਣਾਉਣੀਆਂ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਹਨ